ਹੈਲੋ ਹਾਂਜੀ ਕਿਵੇਂ ਯਾਦ ਕਰਿਆ ਦਵਿੰਦਰ ਵੀਰੇ ਠੀਕ ਆ ਠੀਕ ਆ ਬਹੁਤ ਟਾਈਮ ਬਾਅਦ ਫ਼ੋਨ ਕਰਿਆ ਯਾਰ ਸੁਣਾ ਉਹ ਬਸ ਸਰਕਾਰਾਂ ਦੀ ਪੋਲਸੀ ਓ ਇੱਦਾਂ ਦੀ ਹੋਈ ਵੀ ਆ ਨਾ ਹੁਣ ਆਪਾਂ ਕਣਕ ਜੀਰੀ ਦੇ ਵਿੱਚ ਉਲਝੇ ਹੋਏ ਹਾਂ ਦੇਖੋ ਜੀਰੀ ਨਾਲ਼ ਕਿੰਨਾਂ ਥੱਲੇ ਜਾ ਰਿਹਾ ਪਾਣੀ ਹੋਰ ਕੋਈ ਫਸਲ ਇਹ ਦੇ ਨਹੀਂ ਰਹੇ ਵੀ ਜਿਹਦੇ ਉੱਪਰ ਐੱਮ ਐੱਸ ਪੀ ਲਾਗੂ ਹੋਈ ਵੀ ਹੋਵੇ ਹਾਂ ਬਸ ਆਹੀ ਆਹੀ ਸੋਚ ਨਾ ਸਰਕਾਰਾਂ ਦੀ ਪੋਲਸੀ ਹੈ ਨਾ ਅਸਲ ਦੇ ਵਿੱਚ ਕਿਆ ਮੈਂ ਤੁਹਾਨੂੰ ਦੱਸਦਾ ਕਿ ਮਾੜੀ ਮੋਟੀ ਆਪਾਂ ਨੂੰ ਸਬਜ਼ੀਆਂ ਤਾਂ ਲਾਉਣੀਆਂ ਚਾਹੀਦੀਆਂ ਨਾ ਖਾਣ ਜੋਗੀ ਤਾਂ ਲਾ ਲਓ ਬਸ ਆਹੀ ਹੈ ਨਾ ਸਰਕਾਰਾਂ ਦੀ ਪੋਲਸੀ ਆ ਇਹ ਐੱਸ ਪੀ ਦੇ ਨਹੀਂ ਰਹੇ ਆਪਣੇ ਕੋਲ ਕੋਈ ਦੂਸਰਾ ਸਲਿਊਸ਼ਨ ਹਲ ਏ ਨਹੀਂ ਹੈ ਵੀ ਆਪਾਂ ਕਿੱਧਰ ਜਾਈਏ ਹਾਂ ਵਿੱਚ ਵਿਚੋਲੀਏ ਹੈ ਨਾ ਜਿਹੜੇ ਵਿਚੋਲੀਏ ਨਹੀਂ ਨਿਕਲਦੇ ਹੈ ਵਿਚੋਲੀਏ ਨਿਕਲਣੇ ਚਾਹੀਦੇ ਹੈ ਹੁਣ ਨਹੀਂ ਜਿਵੇਂ ਹੁਣ ਮੰਨ ਲਓ ਆਪਾਂ ਮਤਲਬ ਗੋਭੀ ਲਾ ਲਈ ਗੋਭੀ 'ਚ ਜੇ ਹੁਣ ਆਪਾਂ ਗੋਭੀ ਲਾਊਂਗੇ ਜਾਂ ਕੋਈ ਘੀਆ ਲਾ ਲਈ ਗੋਭੀ ਖਾਣ ਜੋਗੀ ਤਾਂ ਲਾ ਲਉ ਨਾ ਆਪਾਂ ਕਮ ਸੇ ਕਮ ਜਿਹੜੇ ਬੱਚਿਆਂ ਨੂੰ ਸਪਰੇਹਾਂ ਵਾਲੀਆਂ ਚੀਜ਼ਾਂ ਖਾਂਦੇ ਆ ਉਹ ਉਹ ਉਹ ਚੀਜ਼ਾਂ ਤੋਂ ਤਾਂ ਬਚਾਓ ਉਹ ਚੀਜ਼ਾਂ ਤੋਂ ਤਾਂ ਬਚਾਓ ਹੋਜੂ ਹਾਂ ਉਹ ਚੀਜ਼ਾਂ ਤੋਂ ਬਸ ਉਹੀ ਤਾਂ ਗੱਲ ਆ ਬੱਚੇ ਵੀ ਤਾਂ ਹੀ ਨਹੀਂ ਰਹਿ ਕੇ ਉਰੇ ਖੁਸ਼ ਬੱਚੇ ਵੀ ਬਾਹਰ ਨੂੰ ਬਾਹਰ ਨੂੰ ਇਸੇ ਕਾਰਨ ਕਰਕੇ ਜਾ ਰਹੇ ਆ ਨਾ ਬੱਚੇ ਵੀ ਆਈਲੈਟਸ ਕਰਕੇ ਬਾਹਰ ਜਾ ਰਹੇ ਬਾਹਰ ਜਾ ਰਹੇ ਆ ਸਹੀ ਗੱਲ ਨਹੀਂ ਥੋੜ੍ਹਾ ਬਹੁਤਾ ਆਪਾਂ ਨੂੰ ਵੀ ਚਾਹੀਦਾ ਨਾ ਆਪਾਂ ਨੂੰ ਜਿਵੇਂ ਯੂਰੀਆ ਏ ਯੂਰੀਏ ਦਾ ਆਪਾਂ ਸਲਿਊਸ਼ਨ ਲੱਭ ਸਕਦੇ ਹਾਂ ਵੀ ਆਪਾਂ ਰੇਹ ਦੂਸਰਾ ਘ ਘਰ ਦੀ ਖਾਦ ਪਾ ਦਈਏ ਖਾਦ ਪਾਉਣ ਨਾਲ਼ ਹਾਂ ਕੋਈ ਨਹੀਂ ਕੋਈ ਨਹੀਂ ਮਿਲਦੇ ਹਾਂ ਮਿਲਦੇ ਹਾਂ ਓਕੇ ਵੀਰ ਓਕੇ